ਸਿਹਤ ਖੇਤਰ ਇੱਕ ਗਤੀਸ਼ੀਲ ਪ੍ਰਣਾਲੀ ਹੈ ਜੋ ਮਰੀਜ਼ਾਂ ਪ੍ਰਦਾਤਾਵਾਂ ਭੁਗਤਾਨ ਕਰਨ ਵਾਲਿਆਂ ਸਪਲਾਇਰਾਂ ਅਤੇ ਨੀਤੀ ਨਿਰਮਾਤਾਵਾਂ ਵਿਚਕਾਰ ਗੁੰਝਲਦਾਰ ਪਰਸਪਰ ਪ੍ਰਭਾਵ ਨਾਲ ਬਣੀ ਹੈ ਇਹ ਬਿਲਕੁਲ ਇਹ ਹੀ ਜਟਿਲਤਾ ਹੈ ਜੋ ਇਸ ਨੂੰ ਭ੍ਰਿਸ਼ਟਾਚਾਰ ਲਈ ਖ਼ਾਸ ਤੌਰ 'ਤੇ ਕਮਜ਼ੋਰ ਬਣਾਉਂਦੀ ਹੈ ਭ੍ਰਿਸ਼ਟਾਚਾਰ ਜਿਸ ਨੂੰ ਆਮ ਤੌਰ 'ਤੇ ਨਿੱਜੀ ਲਾਭ ਲਈ ਸੌਂਪੀ ਗਈ ਸ਼ਕਤੀ ਦੀ ਦੁਰਵਰਤੋਂ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਵਿਸ਼ਵ ਪੱਧਰ 'ਤੇ ਸਿਹਤ ਸੰਭਾਲ ਪ੍ਰਣਾਲੀਆਂ ਵਿੱਚ ਇੱਕ ਸਮੱਸਿਆ ਹੈ ਹਾਲਾਂਕਿ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਭ੍ਰਿਸ਼ਟਾਚਾਰ ਵਿੱਚ ਨਾ ਸਿਰਫ਼ ਉਹ ਕਾਰਵਾਈਆਂ ਸ਼ਾਮਿਲ ਹੁੰਦੀਆਂ ਹਨ ਜੋ ਜ਼ਿਆਦਾਤਰ ਦੇਸ਼ਾਂ ਵਿੱਚ ਗੈਰ ਕਾਨੂੰਨੀ ਹਨ ਸਗੋਂ ਉਹ ਵੀ ਜਿਨ੍ਹਾਂ ਨੂੰ ਵਾਜਿਬ ਤੌਰ 'ਤੇ ਅਨੈਤਿਕ ਮੰਨਿਆ ਜਾ ਸਕਦਾ ਹੈ ਅਤੇ ਜਦੋਂ ਵਿਆਪਕ ਕਮਜ਼ੋਰ ਹੁੰਦਾ ਹੈ ਅਤੇ ਸਿਹਤ ਪ੍ਰਣਾਲੀਆਂ ਵਿੱਚ ਅਵਿਸ਼ਵਾਸ ਪੈਦਾ ਕਰਦਾ ਹੈ ਭ੍ਰਿਸ਼ਟਾਚਾਰ ਸਿਹਤ ਖੇਤਰ ਦੇ ਅੰਦਰ ਕਈ ਰੂਪ ਲੈ ਲੈਂਦਾ ਹੈ ਅਤੇ ਸਰਕਾਰੀ ਏਜੰਸੀਆਂ ਤੋਂ ਲੈ ਕੇ ਦੇਖਭਾਲ ਦੀ ਸਿੱਧੀ ਵਿਵਸਥਾ ਤੱਕ ਸਾਰੇ ਸੰਗਠਨਾਤਮਕ ਪੱਧਰਾਂ 'ਤੇ ਹੁੰਦਾ ਹੈ ਇਸ ਤਰ੍ਹਾਂ ਸਿਹਤ ਖੇਤਰ ਦੇ ਭ੍ਰਿਸ਼ਟਾਚਾਰ ਦੀਆਂ ਪ੍ਰੇਰਨਾਵਾਂ ਦੇਸ਼ ਅਨੁਸਾਰ ਵੱਖ ਵੱਖ ਹੁੰਦੀਆਂ ਹਨ ਇਸ ਲਈ ਭ੍ਰਿਸ਼ਟਾਚਾਰ ਨੂੰ ਘਟਾਉਣ ਵਾਲੀਆਂ ਰਣਨੀਤੀਆਂ ਨੂੰ ਢਾਲਣਾ ਚੁਣੌਤੀਪੂਰਨ ਹੋ ਸਕਦਾ ਹੈ ਜੋ ਇੱਕ ਸਿਹਤ ਪ੍ਰਣਾਲੀ ਵਿੱਚ ਪੂਰੀ ਤਰ੍ਹਾਂ ਵੱਖੋ ਵੱਖਰੇ ਪ੍ਰੋਤਸਾਹਨ ਜਵਾਬਦੇਹੀ ਢਾਂਚੇ ਲਾਗੂ ਕਰਨ ਦੀਆਂ ਵਿਧੀਆਂ ਅਤੇ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਪ੍ਰਸੰਗਾਂ ਦੇ ਨਾਲ ਦੂਜੀ ਪ੍ਰਣਾਲੀ ਵਿੱਚ ਸਫਲ ਹਨ ਸਿਹਤ ਪ੍ਰਣਾਲੀਆਂ ਦੀ ਵਿਭਿੰਨਤਾ ਅਤੇ ਗਤੀਸ਼ੀਲ ਪ੍ਰਕਿਰਤੀ ਦੇ ਮੱਦੇ ਨਜ਼ਰ ਭ੍ਰਿਸ਼ਟਾਚਾਰ ਵਿੱਚ ਟਿਕਾਊ ਕੌਮੀ ਅਤੇ ਸਿਹਤ ਸੰਭਾਲ ਡਿਲੀਵਰੀ ਵਿੱਚ ਨਤੀਜੇ ਵਜੋਂ ਸੁਧਾਰਾਂ ਲਈ ਇੱਕ ਸਿਸਟਮ ਸੋਚਣ ਵਾਲੀ ਪਹੁੰਚ ਦੀ ਲੋੜ ਹੁੰਦੀ ਹੈ ਹਾਂ ਇਸ ਤਰ੍ਹਾਂ ਮੈਂ ਵੀ ਸਿਹਤ ਪ ਸੰਭਾਲ ਖੇਤਰ ਵਿੱਚ ਭ੍ਰਿਸ਼ਟਾਚਾਰ ਦੀ ਸ਼ਿਕਾਰ ਹੋਈ ਹਾਂ